ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈ ਸੈਂਟਰਲ ਯੂਨੀਵਰਸਿਟੀ ਤੋਂ ਗੱਲ ਕਰ ਰਿਹਾ ਸੀ ਵਿਪਿਨ ਸਰ ਸੋਨੀ ਟ੍ਰੈਵੇਲ ਤੋ ਗੱਲ ਕਰ ਰਹੇ ਹੋ ਨਾ ਸਰ ਐਕਚੁਲੀ ਮੈਂ ਅੱਜ ਤੋਂ ਦਸ ਦਿਨ ਪਹਿਲਾਂ ਗਿਆ ਸੀ ਤੁਹਾਡੇ ਨਾਲ ਚੰਡੀਗੜ੍ਹ ਗਿਆ ਸੀਗਾ ਹਾਂਜੀ ਸਰ ਹਾਂਜੀ ਸਰ ਮੈਨੂੰ ਇਨੋਵਾ ਗੱਡੀ ਚਾਹੀਦੀ ਸੀ ਤੁਹਾਡੀ ਮੈਨੂੰ ਨਹੀਂ ਸਰ ਮਤਲਬ ਟਰੈਵਲ ਤੁਹਾਡੇ ਨਾਲ ਬਹੁਤ ਵਧੀਆ ਮਤਲਬ ਟਰੈਵਲ ਹੋ ਰਿਹਾ ਹੈ ਨਾ ਵੀ ਤੁਹਾਡੀ ਗੱਡੀ ਵੀ ਕਾਫੀ ਉਹ ਸੀਗੀ ਬਾਕੀ ਤੁਹਾਡਾ ਬੋਲਣ ਚਾਲਣ ਦਾ ਤਰੀਕਾ ਹੀ ਬਹੁਤ ਵਧੀਆ ਸੀਗਾ ਹੈ ਨਾ ਸਰ ਮੈਨੂੰ ਇਹ ਗੱਡੀ ਚਾਹੀਦੀ ਹੈ ਜੀ ਹੁਣ ਅਠਾਰਾਂ ਤਰੀਕ ਨੂੰ ਸਰ ਅਠਾਰਾਂ ਜੂਨ ਨੂੰ ਸਰ ਹਾਂਜੀ ਸਰ ਹਾਂਜੀ ਇਹ ਸਰ ਮਤਲਬ ਚੰਡੀਗੜ੍ਹ ਤੋਂ ਉਹਨਾਂ ਨੇ ਸੈਂਟਰਲ ਯੂਨੀਵਾਰਸਿਟੀ ਆਉਣਾ ਸਰ ਮਤਲਬ ਤੁਸੀਂ ਡ੍ਰਾਈਵਰ ਉਹੀ ਭੇਜਿਓ ਜਿਹੜਾ ਤੁਸੀਂ ਮੇਰੇ ਨਾਲ ਪਹਿਲਾਂ ਭੇਜਿਆ ਸੀ ਹੈ ਨਾ ਸਰ ਐਕਚੁਲੀ ਉਹ ਮੇਰੇ ਮਤਲਵ ਚੀਫ਼ ਗੈਸਟ ਆ ਰਹੇ ਹੈ ਵੀ ਮਤਲਬ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਕਿਉਕਿ ਸਰ ਐਕਚੁਲੀ ਇੱਦਾਂ ਹੈ ਮਤਲਬ ਜਿਹੜੇ ਚੀਫ਼ ਗੈਸਟ ਉਹ ਜ਼ਿਆਦਾ ਹੀ ਮਤਲਬ ਕੁਛ ਹੈ ਨਾ ਅਤੇ ਸਰ ਚਾਰਜਿਸ ਵਗੈਰਾ ਉਹੀ ਹੋਣਗੇ ਨਾ ਹਾਂਜੀ ਸਰ ਹਾਂਜੀ ਹਾਜੀ ਸਰ ਫਿਰ ਮੈਂ ਤੋ ਤੁਸੀਂ ਕੰਨਫ਼ਰਮੇਸਨ ਕਦੋਂ ਦਿਓਗੇ ਮੈਨੂੰ ਇਸ ਚੀਜ਼ ਦੀ ਸਰ ਹਾਂ ਸਰ ਮੈਨੂੰ ਐਕਚੁਲੀ ਕੰਨਫ਼ਰਮੇਸਨ ਦੇ ਦਿਓ ਜੀ ਇਹਦੀ ਕੰਨਫ਼ਰਮੇਸਨ ਦੇ ਦੇਵੋਗੇ ਫਿਰ ਮੈਂ ਅਗਾਹਾਂ ਸਰ ਉਹ ਵੀ ਕਰਵਾਉਣਾ ਹੈਗਾ ਹੈ ਨਾ ਸਰ ਤੁਸੀਂ ਮੈਨੂੰ ਬਿਲ ਪ੍ਰੋਵਾਈਡ ਪ੍ਰੋਵਾਇਡ ਕਰਵਾ ਦੇਵੋਗੇ ਨਾ ਇਸ ਦੇ ਹਾਂ ਸਰ ਕਿਉਂਕਿ ਜੇ ਤੁਸੀਂ ਬਿਲ ਪ੍ਰੋਵਾਈਡ ਕਰਵਾਓਗੇ ਕਿਉਂਕਿ ਤੁਹਾਨੂੰ ਪਤਾ ਹੀ ਯੂਨੀਵਾਰਸਿਟੀ ਮੈਂ ਰਿਵਰਸਮੈਂਟ ਵੀ ਲੈਣੀ ਹੁੰਦੀ ਫਿਰ ਹੈ ਨਾ ਹਾਂ ਸਰ ਤੁਸੀਂ ਮੈਨੂੰ ਬਿਲ ਪ੍ਰੋਵਾਇਡ ਕਰਵਾ ਦਿਓ ਜੀ ਠੀਕ ਹੈ ਸਰ ਸਰ ਫਾਇਨਲ ਹੈ ਨਾ ਹੁਣ ਤਰੀਕ ਜੀ ਹਾਂਜੀ ਸਰ ਹਾਂਜੀ ਪੇਮੈਂਟ ਸਰ ਹਾਂ ਕੈਸ਼ ਕੈਸ਼ ਕਰਦਾ ਹਾਂ ਸਰ ਕੋਈ ਇਸ਼ੂ ਨਹੀਂ ਠੀਕ ਹੈ ਸਰ ਥੈਂਕ ਯੂ ਓਕੇ ਸਰ ਓਕੇ ਥੈਂਕ ਯੂ